ਕੁਝ ਵਿਲੱਖਣ ਪਕਵਾਨ ਜੋ ਸਾਡੇ ਪਕਵਾਨਾਂ ਦਾ ਹਿੱਸਾ ਹਨ ਉਹ ਹਨ ਖੰਡ ਮਸਾਲੇ ਗੁੜ ਨਮਕ ਆਦਿ ਹਿੱਸਾ ਹੁੰਦੇ ਹਨ ਜਿਵੇਂ ਅਸੀਂ ਪਕਵਾਨਾਂ ਨੂੰ ਤਿਆਰ ਕਰਨਾ ਹੈ ਉਹਨੂੰ ਖੰਡ ਜ਼ਿਆਦਾ ਅਸੀਂ ਚਾਹ ਬਰਫੀ ਕੜਾਹ ਅਤੇ ਹੋਰ ਪਕਵਾਨ ਬਣਾਉਣ ਲਈ ਜ਼ਿਆਦਾ ਮਿੱਠੇ ਦੀ ਵਰਤੋਂ ਕਰਦੇ ਹਨ ਖੰਡ ਦੀ ਚਾਸ਼ਨੀ ਵੀ ਤਿਆਰ ਕਰਦੇ ਹਾਂ ਹੋਰ ਵੀ ਥਾਵਾਂ 'ਤੇ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਮਸਾਲੇ ਵੀ ਅਸੀਂ ਸਬਜ਼ੀਆਂ ਬਣਾਉਣ ਸਮੇਂ ਵਰਤਦੇ ਹਨ ਗਰਮ ਮਸਾਲਾ ਆਪਾਂ ਰੋਜ਼ਾਨਾ ਸਬਜ਼ੀ ਦੇ ਵਿੱਚ ਵਰਤਦੇ ਹਨ ਚਾਹ ਦਾ ਮਸਾਲਾ ਵੀ ਹੁੰਦਾ ਹੈ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਮਸਾਲੇ ਹੁੰਦੇ ਹਨ ਜਿਵੇਂ ਮੀਟ ਮਸਾਲਾ ਚਨਾ ਮਸਾਲਾ ਇਹ ਮਸਾਲੇ ਸਬਜ਼ੀਆਂ ਦਾ ਸਵਾਦ ਵਧਾਉਣ ਨੂੰ ਹੁੰਦੇ ਹਨ ਅਤੇ ਘਰਾਂ ਵਿੱਚ ਆਮ ਵਰਤੇ ਜਾਂਦੇ ਹਨ ਗੁੜ ਵੀ ਇੱਕ ਵਿਲੱਖਣ ਪਕਵਾਨ ਹੈ ਇਹ ਵੀ ਰੋਜ਼ਾਨਾ ਚਾਹ ਵਿੱਚ ਵੀ ਵਰਤ ਸਕਦੇ ਹਾਂ ਗੁੜ ਸ਼ੂਗਰ ਦੇ ਮਰੀਜ਼ ਲਈ ਇਕ ਚੰਗਾ ਸਾਬਤ ਪਕਵਾਨ ਹੈ ਗੁੜ ਦੇ ਗੁੜ ਦਾ ਪ੍ਰਯੋਗ ਸ਼ਰਾਬ ਦੇ ਲਈ ਵੀ ਕੀਤਾ ਜਾਂਦਾ ਹੈ ਇਹ ਸਾਡੇ ਪਕਵਾਨ ਆਪਣੇ ਭੋਜਨ ਦੇ ਲਈ ਵਿਲੱਖਣ ਸਾਬਿਤ ਹੁੰਦੇ ਹਨ